ਰੋਪੜ ਸ਼ ਜ਼ਿਲ੍ਹੇ ਦਾ ਮਸ਼ਹੂਰ ਹੋਲਾ ਮਹੱਲਾ ਹੈ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਜਿੱਥੇ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦੇ ਜ਼ੋਰ ਵ ਦੇਖਣ ਵਾਸਤੇ ਮਨਾਇਆ ਜਾਂਦਾ ਹੈ ਉੱਥੇ ਗੱਤਕਾਂ ਦੀਆਂ ਕਾਫੀ ਤਰ੍ਹਾਂ ਦੀਆਂ ਗੇਮਾਂ ਕੋਂਪੀਟੀਸ਼ਨ ਕਰਵਾਏ ਜਾਂਦੇ ਆ ਜਿਹਨਾਂ ਦੇ ਵਿੱਚ ਗੱਤਕਾ ਖੇਡੀ ਜਾਂਦੀ ਹੈ ਕਿਰਪਾਨਾਂ ਨੇਜਿਆਂ ਦੇ ਨਾਲ ਖੇਡੀਆਂ ਜਾਂਦੀਆਂ ਹਨ